ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਓਰੋਬਾਈਟ ਤੋਂ ਬੋਲ ਰਹੇ ਹੋ ਹਾਂਜੀ ਅੱਜ ਮੇਰਾ ਬ੍ਰਡੇ ਸੀਗਾ ਅਤੇ ਮੈਂ ਬ੍ਰਡੇ ਪਾਰਟੀ ਲਈ ਕੁਛ ਮਤਲਬ ਖਾਣ ਲਈ ਅਤੇ ਕੁਛ ਕੋਲਡ ਡਰਿੰਕਸ ਔਡਰ ਕਰਨੀਆਂ ਸੀਗੀਆ ਅਤੇ ਜਿਹੜਾ ਖਾਣ ਲਈ ਹੈ ਮੈਨੇ ਪੀਜ਼ਾ ਬਰਗਰ ਪੈਟੀਜ਼ ਅਤੇ ਬ੍ਰੈੱਡ ਕੇਕ ਅਤੇ ਨਿਊਡਲਜ਼ ਔਡਰ ਕਰਨੀਆਂ ਸੀ ਅਤੇ ਡਰਿੰਕ ਦੇ ਵਿੱਚ ਮੈਨੇ ਬਨਾਨਾ ਸ਼ੇਕ ਮੈਗੋ ਸ਼ੇਕ ਅਤੇ ਕਰੰਟ ਸ਼ੇਕ ਇਹ ਤਿੰਨੋ ਔਡਰ ਕਰਨੇ ਸੀਗੇ ਕੀ ਤੁਸੀਂ ਔਡਰ ਕਰ ਸਕ ਮਤਲਬ ਡਿਲੀਵਰੀ ਕਰ ਸਕਦੇ ਹੋ ਮੈਂ ਤੁਹਾਨੂੰ ਆਪਣਾ ਐ ਐਡਰੈੱਸ ਅਤੇ ਉਹ ਮੈਨਸ਼ਨ ਕਰ ਦਿੰਦੀ ਹਾਂ ਅਤੇ ਤੁਸੀਂ ਔਡਰ ਕਰ ਦਿਓ ਪਲੀਸ ਥੈਂਕ ਯੂ